ਅੱਜ ਕੱਲ੍ਹ ਦੇ ਸੂਟਾਂ ਦੇ ਬਹੁਤ ਸਾਰੇ ਰੰਗ ਮਸ਼ਹੂਰ ਹਨ ਜਿਵੇਂ ਕਿ ਹਰਾ ਪੀਲਾ ਬੈਂਗਣੀ ਅਤੇ ਪਿਆਜੀ ਇਸ ਤੋਂ ਇਲਾਵਾ ਗੁਲਾਬੀ ਨੀਲਾ ਪਿੰਕ ਗਰੇਅ ਅਤੇ ਬਹੁਤ ਸਾਰੇ ਰੰਗ ਫੈਸ਼ਨ ਵਿੱਚ ਹਨ ਇਸ ਵਿੱਚ ਬਹੁਤ ਸਾਰੇ ਡਿਜਾਈਨ ਸੂਟਾਂ ਦੇ ਸੋਹਣੇ ਸੋਹਣੇ ਹਨ ਜਿਵੇਂ ਕਿ ਸ਼ਰਾਰਾ ਲਹਿੰਗਾ ਅਨਾਰਕਲੀ ਸੂਟ ਪੈਂਟ ਪਲਾਜੋ ਆਦਿ ਸੂਟ ਮਸ਼ਹੂਰ ਹਨ ਡਿਜਾਇਨ ਵਿੱਚ ਹਨ ਮੈਨੂੰ ਸ਼ਰਾਰਾ ਸੂਟ ਅਤੇ ਅਨਾਰਕਲੀ ਸੂਟ ਅਤੇ ਪੈਂਟ ਪਲਾਜੋ ਸੂਟ ਬਹੁਤ ਜ਼ਿਆਦਾ ਪਸੰਦ ਹਨ ਮੈਨੂੰ ਰੰਗਾਂ ਵਿੱਚ ਬੈਂਗਣੀ ਰੰਗ ਅਤੇ ਪੀਲਾ ਰੰਗ ਬਹੁਤ ਜ਼ਿਆਦਾ ਪਸੰਦ ਹੈ